ਹੈਲੋ ਹਾਂ ਯਾਰ ਮੈਂ ਨਾ ਕਰੋਕਰੀ ਮੰਗਵਾਈ ਸੀਗੀ ਐਮਜ਼ੋਨ ਤੋਂ ਦੇਖਣ ਨੂੰ ਯਾਰ ਬੜੀ ਸੋਹਣੀ ਲੱਗ ਰਹੀ ਸੀ ਮੈਨੂੰ ਤੈਨੂੰ ਪਤਾ ਮੈਨੂੰ ਵੈਸੇ ਵੀ ਕਿਚਨ ਦਾ ਕ ਕੁਕਿੰਗ ਦਾ ਬਹੁਤ ਸ਼ੌਕ ਹੈ ਹੈ ਨਾ ਅਤੇ ਮੈਂ ਬੜੇ ਚਾਅ ਨਾਲ਼ ਮੰਗਵਾਈ ਕਰੋਕਰੀ ਸੈੱਟ ਸੀਗਾ ਬਹੁਤ ਸੋਹਣਾ ਲੱਗ ਰਿਹਾ ਸੀ ਡਿਨਰ ਸੈੱਟ ਦੇਖਣ ਨੂੰ ਅਤੇ ਉਹ ਕਹਿੰਦੇ ਸੀ ਤਿੰਨ ਦਿਨਾਂ 'ਚ ਡਿਲੀਵਰੀ ਹੋਜੂਗੀ ਪਹਿਲਾਂ ਤਾਂ ਤਿੰਨ ਦਿਨਾਂ 'ਚ ਡਿਲੀਵਰੀ ਨਹੀਂ ਹੋਈ ਪੰਜ ਛੇ ਦਿਨ ਲੱਗ ਗਏ ਡਿਲੀਵਰੀ ਨੂੰ ਹੈਂ ਅਤੇ ਡਿਲੀਵਰੀ ਆਈ ਤਾਂ ਪੈਕਿੰਗ ਨਹੀਂ ਸਹੀ ਸੀਗੀ ਅਤੇ ਜਿਸ ਤਰ੍ਹਾਂ ਦੀ ਮੈਂ ਕੁਆਲਿਟੀ ਉਹ ਦਿਖਾ ਰਹੇ ਸੀਗੇ ਉਸ ਤਰ੍ਹਾਂ ਦੀ ਨਹੀਂ ਸੀਗੀ ਬਹੁਤ ਹੀ ਘਟੀਆ ਕੁਆਲਿਟੀ ਦਾ ਸਮਾਨ ਸੀਗਾ ਹਲਕਾ ਸੀਗਾ ਕਹਿੰਦੇ ਸੀ ਵਾਈਟ ਕਲਰ ਦਾ ਡਿਨਰ ਸੈੱਟ ਸੀਗਾ ਅਤੇ ਕਹਿੰਦੇ ਸੀਗੇ ਵੀ ਹਾਂ ਦਾਗ਼ ਨਿਸ਼ਾਨ ਨਹੀਂ ਪੈਣਗੇ ਯੇ ਹੈ ਵੋ ਹੈ ਅਤੇ ਇੱਦਾਂ ਦਾ ਕੁਛ ਵੀ ਨਹੀਂ ਹੈ ਔਰ ਇੱਕ ਵਾਰੀ ਯੂਜ ਕੀਤਾ ਤਾਂ ਨਾਲ਼ ਹੀ ਨਿਸ਼ਾਨ ਪੈ ਗਏ ਖਰਾਬ਼ ਹੋ ਗਿਆ ਹੈਂ ਮੇਰਾ ਤਾਂ ਬਹੁਤ ਮੂਡ ਖ਼ਰਾਬ ਹੋਇਆ ਯਾਰ ਹੈਂ ਮੇਰਾ ਤਾਂ ਦਿਲ ਏ ਨਹੀਂ ਕਰਦਾ ਵੀ ਮੈਂ ਹੁਣ ਦੁਬਾਰਾ ਔਨਲਾਈਨ ਔਡਰ ਕਰਾਂ ਅਤੇ ਉਹ ਵੀ ਐਮਾਜ਼ੋਨ ਤੋਂ